ਹਾਂਜੀ ਸਾਡੇ ਪਿੰਡ ਇੱਕ ਟੋਭਾ ਟੋਭੇ ਦੇ ਕੋਲ ਇੱਕ ਬਹੁਤ ਪੁਰਾਣਾ ਖੂਹ ਹੈ ਜਿਹੜਾ ਕਿ ਬਹੁਤ ਇੱਕ ਯਾਦਗਾਰੀ ਤੌਰ 'ਤੇ ਹੈਗਾ ਪਿੰਡ ਦੇ ਵਿੱਚ ਅਤੇ ਉਹ ਉੱਥੇ ਉਹ ਟਿਊਬਵੈੱਲ ਚੱਲਦਾ ਜਿਹੜਾ ਉੱਥੇ ਸਾਰੇ ਲੋਕ ਤਕਰੀਬਨ ਜਿਹੜੇ ਨੇੜੇ ਤੇੜੇ ਦੇ ਨੇ ਪਿੰਡ ਦੇ ਲੋਕ ਭੇਡਾਂ ਨੂੰ ਜਾਂ ਬੱਕਰੀਆਂ ਨੂੰ ਉੱਥੇ ਪਾਣੀ ਪਿਲਾਉਂਦੇ ਨੇ ਲੋਕ ਕਈ ਮੱਝਾਂ ਨੂੰ ਵੀ ਪਾਣੀ ਪਿਲਾ ਕੇ ਗਾਵਾਂ ਨੂੰ ਵੀ ਲੈ ਕੇ ਜਾਂਦੇ ਹਨ ਉੱਥੇ ਅਤੇ ਉਹ ਬਹੁਤ ਪੁਰਾਣਾ ਟਿਊਬਵੈੱਲ ਹੈ ਬਹੁਤ ਵਧੀਆ ਉਸਦਾ ਪਾਣੀ ਹੈ ਸਾਫ਼ ਸੁਥਰਾ ਪਾਣੀ ਹੈ ਸਾਰੇ ਉਸਨੂੰ ਪੀਂਦੇ ਨੇ ਘਰਾਂ ਦੇ ਵਿੱਚ ਵੀ ਲੈ ਕੇ ਜਾਂਦੇ ਹਨ ਪਾਣੀ ਕਈ ਲੋਕ ਤਾਂ ਉਹਨਾਂ ਦੇ ਵਿੱਚੋਂ ਕਿ ਉਸ ਦਾ ਪਾਣੀ ਇੰਨਾ ਸਵਾਦ ਅਤੇ ਮਿੱਠਾ ਹੈ